ਪੌਦਿਆਂ ਲਈ ਵੱਖ ਵੱਖ ਮੌਸਮਾਂ ਦੇ ਆਧਾਰ 'ਤੇ ਬਹੁਤ ਸਾਰੀਆਂ ਸਾਵਧਾਨੀਆਂ ਵਰਤੀਆਂ ਜਾਂਦੀਆਂ ਹਨ ਜਿਵੇਂ ਕਿ ਗਰਮੀਆਂ ਦੇ ਵਿੱਚ ਅੰਤਾਂ ਦੀ ਗਰਮੀ ਪੈਂਦੀ ਹੈ ਅਤੇ ਸਾਨੂੰ ਪੌਦਿਆਂ ਦੇ ਵਿੱਚ ਰੋਜ਼ ਪਾਣੀ ਪਾਉਣਾ ਚਾਹੀਦਾ ਹੈ ਜਿਸ ਨਾਲ ਪੌਦੇ ਵਧੀਆ ਵੱਡੇ ਹੋਣ ਉਹਨਾਂ ਨੂੰ ਮਿਲਦਾ ਪਾਣੀ ਮਿਲ ਸਕੇ ਅਤੇ ਬਰਸਾਤਾਂ ਵਿੱਚ ਸਾਨੂੰ ਮੀਂਹ ਬਹੁਤ ਪੈਂਦੇ ਨੇ ਅਤੇ ਇਹਨਾਂ ਦਾ ਪਾਣੀ ਵੀ ਦੇਖਣਾ ਚਾਹੀਦਾ ਹੈ ਵੀ ਜ਼ਿਆਦਾ ਪਾਣੀ ਨਾਲ ਬੂਟੇ ਖਰਾਬ ਨਾ ਹੋ ਜਾਣ ਪੌਦੇ ਅਤੇ ਸਰਦੀਆਂ ਦੇ ਵਿੱਚ ਇਹਦਾ ਕੋਰੇ ਤੋਂ ਬਚਾਉਣ ਲਈ ਅਸੀਂ ਸ਼ੈੱਡ ਪਾ ਦਿੰਦੇ ਹਾਂ ਬੂਟਿਆਂ ਦੇ ਉੱਪਰ ਵੀ ਕੋਰੇ ਨਾਲ ਇਹਨਾਂ 'ਤੇ ਕੁਛ ਵੀ ਨਾ ਹਾਨੀ ਨਾ ਹੋਵੇ ਇਹਨਾਂ ਨੂੰ ਅਤੇ ਦੇਖਿਆ ਜਾਵੇ ਜ਼ੀਰੀ ਦੀ ਫਸਲ ਸਾਨੂੰ ਜਿਵੇਂ ਬਰਸਾਤਾਂ ਵਿੱਚ ਕਈ ਵਾਰ ਮੀਂਹ ਬਹੁਤ ਪੈਂਦੇ ਹਨ ਸਾਨੂੰ ਜ਼ੀਰੀ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਫੇਰ ਪਾਣੀ ਜ਼ੀਰੀ 'ਚ ਕਾਫੀ ਲੱਗਦਾ ਹੈ ਮੋਟਰਾਂ ਐਨਾ ਪਾਣੀ ਪੂਰਾ ਨਹੀਂ ਕਰ ਸਕਦੀਆਂ ਮੀਂਹ ਦੇ ਪਾਣੀ ਨਾਲ ਜ਼ੀਰੀ ਦੀ ਫਸਲ ਬਹੁਤ ਵਧੀਆ ਹੁੰਦੀ ਹੈ